ਸਤਿ ਸ਼੍ਰੀ ਅਕਾਲ ਜੀ ਮੈਂ ਨਵਨੀਤ ਕੌਰ ਮੋਹਾਲੀ ਤੋਂ ਬੋਲ ਰਹੀ ਹਾਂ ਕੀ ਤੁਸੀਂ ਜਲੰਧਰ ਹਵੇਲੀ ਤੋਂ ਬੋਲ ਰਹੇ ਹੋ ਦੋ ਦਿਨ ਬਾਅਦ ਅਸੀਂ ਮੋਹਾਲੀ ਤੋਂ ਅੰਮ੍ਰਿਤਸਰ ਤੱਕ ਆਉਣਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੀ ਹਵੇਲੀ ਵਿੱਚ ਰਾਤ ਦਾ ਖਾਣਾ ਖਾਈਏ ਕਿਉਂਕਿ ਅਸੀਂ ਘਰ ਤੋਂ ਛੇਤੀ ਨਿਕਲਣਾ ਹੈ ਅਤੇ ਅਸੀਂ ਘਰ ਤੋਂ ਖਾਣਾ ਖਾ ਕੇ ਨਹੀਂ ਨਿਕਲਾਂਗੇ ਤੁਹਾਡੀ ਹਵੇਲੀ ਤੱਕ ਪਹੁੰਚਦਿਆਂ ਸਾਨੂੰ ਬਾਰ੍ਹਾ ਇੱਕ ਵੱਜ ਜਾਣਗੇ ਅਤੇ ਜਦੋਂ ਅਸੀਂ ਜਲੰਧਰ ਆਵਾਂਗੇ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਹਵੇਲੀ 'ਚ ਖਾਣਾ ਖਾਈਏ ਪਰ ਸਾਡੇ ਕੋਲ ਇੰਨਾ ਸਮਾਂ ਨਹੀਂ ਹੋਵੇਗਾ ਕਿ ਅਸੀਂ ਤੁਹਾਡੀ ਹਵੇਲੀ 'ਚ ਆ ਕੇ ਉੱਥੇ ਬੈਠ ਕੇ ਖਾਣਾ ਖਾ ਸਕੀਏ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਕੋਈ ਹਵੇਲੀ ਦਾ ਬੰਦਾ ਸਾਨੂੰ ਆ ਕੇ ਰੋਡ 'ਤੇ ਸਾਡਾ ਔਰਡਰ ਫੜਾ ਜਾਵੇ ਜੇਕਰ ਉਹ ਔਰਡਰ ਫੜਾ ਸਕਦਾ ਹੈ ਤਾਂ ਸਾਡਾ ਔਰਡਰ ਹੈ ਦੋ ਦਸ ਤੰਦੂਰੀ ਰੋਟੀਆਂ ਦੋ ਮਲਾਈ ਮੱਖਣੀ ਦੋ ਦਾਲ਼ ਅਤੇ ਇੱਕ ਪਨੀਰ ਦੀ ਭੁਰਜੀ ਬਸ ਅਤੇ ਇਹ ਸਾਡਾ ਔਰਡਰ ਹੈ ਜੇਕਰ ਕੋਈ ਵੀ ਤੁਹਾਡਾ ਬੰਦਾ ਉੱਥੇ ਰੋਡ 'ਤੇ ਆ ਕੇ ਸਾਨੂੰ ਫੜਾ ਸਕਦਾ ਹੈ ਤਾਂ ਉਹ ਫੜਾ ਜਾਵੇ ਧੰਨਵਾਦ